ਜਿਵੇਂ ਕਿ ਦੱਸਿਆ ਗਿਆ ਹੈ ਮੈਂ ਇੱਕ ਸਿਹਤ ਕੈਂਪ ਵਿੱਚ ਵਲੰਟੀਅਰ ਦੇ ਤੌਰ 'ਤੇ ਕੰਮ ਕਰਨਾ ਚਾਹੁੰਦੀ ਹਾਂ ਇਸ ਲਈ ਮੈਨੂੰ ਸਭ ਤੋਂ ਪਹਿਲਾਂ ਸੰਗਠਨ ਦੀ ਵੈਬਸਾਈਟ 'ਤੇ ਜਾਨਾ ਪਏਗਾ ਫਿਰ ਮੈਂ ਆਪਦੀ ਡਿਟੇਲਸ ਭਰਾਂਗੀ ਇਸ ਵਿੱਚ ਸਭ ਤੋਂ ਮੈਂ ਪਹਿਲਾਂ ਆਪਦਾ ਨਾਮ ਜਨਮ ਤਿਥੀ ਜਨਮ ਸਥਾਨ ਭਰਨਾ ਪਏਗਾ ਫਿਰ ਉਸ ਤੋਂ ਬਾਅਦ ਮੈਂ ਆਪਦਾ ਐਡਰੈਸ ਜੋ ਜਿੱਥੇ ਮੈਂ ਪ੍ਰੈਜੈਂਟਲੀ ਰਹਿ ਰਹੀ ਹਾਂ ਉਹ ਫਿਲ ਕਰਾਂਗੀ ਇਸ ਤੋਂ ਬਾਅਦ ਆਪਦੇ ਸ਼ਹਿਰ ਦਾ ਨਾਮ ਜਿਸ ਵਿੱਚ ਮੈਂ ਰਹਿ ਰਹੀ ਹਾਂ ਪਿਨ ਕੌਡ ਅਤੇ ਉਸ ਤੋਂ ਬਾਅਦ ਆਪਦਾ ਫੋਨ ਨੰਬਰ ਫਿਰ ਉਸ ਤੋਂ ਬਾਅਦ ਮੈਂ ਆਪਦੀ ਡਿਗਰੀ ਜੋ ਵੀ ਮੇਰੇ ਕੋਲ ਮੈਡੀਕਲ ਪ੍ਰੋਫੈਸ਼ਨ ਦੀ ਡਿਗਰੀ ਹੈ ਜਿਸ ਕਰਕੇ ਮੈਂ ਇਸ ਕਿੱਤੇ ਲਈ ਬਿਲਕੁਲ ਯੋਗਿਆ ਯੋਗ ਹਾਂ ਜਿਸ ਕਰਕੇ ਮੈਂ ਇਹ ਸੇਵਾਵਾਂ ਪ੍ਰਦਾਨ ਕਰਨਾ ਚਾਹੁੰਦੀ ਹਾਂ ਉਹ ਮੈਂ ਆਪਦੀ ਡਿਗਰੀ ਜੋ ਵੀ ਮੇਰੇ ਕੋਲ ਹੈ ਪ੍ਰੋਫੈਸ਼ਨਲ ਮੈਂ ਨਾਲ ਅਟੈਚ ਕਰੂੰਗੀ ਉਹ ਸਾਰੀ ਮੈਂ ਕੁਆਲੀਫਿਕੇਸ਼ਨ ਫਿਲ ਕਰੂੰਗੀ ਫਾਰਮ ਵਿੱਚ ਰਜਿਸਟਰੇਸ਼ਨ ਨੰਬਰ ਵਗੈਰਾ ਫੋਨ ਨੰਬਰ ਭਰ ਕੇ ਮੈਂ ਫੋਰਮ ਸਬਮਿਟ ਕਰਵਾ ਦੂੰਗੀ